ਟੈਕਨੋਲੋਜੀ ਨੇ ਬਾਕੀ ਖੇਤਰਾਂ ਵਾਂਗ ਕਲਾ ਉਦਯੋਗ ਦੇ ਵਿੱਚ ਵੀ ਬਹੁਤ ਵੱਡਾ ਰੈਵੋਲਊਸ਼ਨ ਲੈ ਕੇ ਆਂਦਾ ਹੈ ਜਿਵੇਂ ਕਿ ਪਹਿਲਾਂ ਸਿਰਫ਼ ਦੋ ਹੀ ਮਾਧਿਅਮ ਹੁੰਦੇ ਸੀਗੇ ਕਲਾਕਾਰਾਂ ਨੂੰ ਆਪਣਾ ਹੁਨਰ ਦਿਖਾਉਣ ਦੇ ਲਈ ਦੂਰਦਰਸ਼ਨ ਔਰ ਇੱਕ ਸਿਨੇਮਾਘਰ ਅਤੇ ਜਾਂ ਥੀਏਟਰਸ ਹੁੰਦੇ ਸੀਗੇ ਹੁਣ ਟੈਕਨੋਲੋਜੀ ਦੇ ਨਾਲ ਓ ਟੀ ਟੀ ਮੀਡੀਅਮ ਆ ਗਿਆ ਵੱਖਰੇ ਵੱਖਰੇ ਸੋਸ਼ਲ ਮੀਡੀਆ ਪਲੇਟਫਾਰਮਸ ਹੈਗੇ ਨੇ ਜਿਹਨਾਂ ਦੇ ਜਿਹਨਾਂ ਦੀ ਵਰਤੋਂ ਕਰਕੇ ਜੋ ਕਲਾਕਾਰ ਹੈਗੇ ਨੇ ਆਪਣਾ ਹੁਨਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਦੇ ਕਾਬਲ ਹੋ ਸਕੇ ਇਹਦੇ ਨਾਲ ਕੀ ਹੈਗਾ ਵਿਦ ਦਾ ਹੈਲਪ ਆਫ ਟੈਕਨੋਲੋਜੀ ਜਿਹੜੇ ਕਲਾਕਾਰ ਬੜੇ ਹੀ ਗੁੰਮਨਾਮੀ ਦੇ ਵਿੱਚ ਰਹਿ ਜਾਂਦੇ ਸੀਗੇ ਉਹਨਾਂ ਨੂੰ ਇੱਕ ਮੌਕਾ ਮਿਲਿਆ ਆਪਣਾ ਹੁਨਰ ਦਿਖਾਉਣ ਦੇ ਲਈ ਔਰ ਸਾਡੇ ਕੋਲ ਬਹੁਤ ਸਾਰੀਆਂ ਇਗਜਾਮਪਲਾਂ ਹੈਗੀਆਂ ਨੇ ਜਿਹਨਾਂ ਦੇ ਜਿਹਨਾਂ ਨੂੰ ਦੇਖ ਕੇ ਅਸੀਂ ਅੰਦਾਜ਼ਾ ਲਗਾ ਸਕਦੇ ਹੈਗੇ ਹਾਂ ਵੀ ਇਹ ਕਲਾਕਾਰ ਅਗਰ ਇਹ ਟੈਕਨੋਲੋਜੀ ਦੀ ਹੈਲਪ ਨਾ ਹੁੰਦੀ ਅਤੇ ਇਹ ਕਲਾਕਾਰ ਸ਼ਾਇਦ ਕਿਸੇ ਗੁੰਮਨਾਮੀ ਦੇ ਦੌਰ ਦੇ ਵਿੱਚ ਗਾਇਬ ਹੋ ਜਾਂਦਾ ਪਰ ਇਹਦੇ ਨਾਲ ਜਿਹੜਾ ਹੈਗਾ ਸਾਨੂੰ ਬਹੁਤ ਸਾਰੇ ਕਲਾਕਾਰਾਂ ਦਾ ਹੁਨਰ ਦੇਖਣ ਨੂੰ ਮਿਲਿਆ ਹੈਗਾ ਟੈਕਨੋਲੋਜੀ ਦੇ ਨਾਲ ਜਿਹੜੇ ਕਲਾਕਾਰ ਹੈਗੇ ਨੇ ਇਹਨਾਂ ਨੂੰ ਜਿਹੜੇ ਆਨਲਾਈਨ ਲਰਨਿੰਗ ਵਾਲਾ ਪਾਰਟ ਹੈ ਉਹਦੇ 'ਚ ਵੀ ਬਹੁਤ ਸਾਰੀ ਮਦਦ ਮਿਲੀ ਹੈਗੀ ਆ ਬੜੇ ਸਾਰੇ ਪਲੈਟਫਾਰਮਸ ਹੈਗੇ ਨੇ ਜਿਹੜੇ ਬਿਨਾਂ ਕੋਈ ਪੈਸਾ ਲਿਆਂ ਫਰੀ ਆਫ ਕੋਸਟ ਜਿਹੜੀ ਹੈਗੀ ਆ ਇੱਕ ਜਨਰਲ ਪਬਲਿਕ ਦੀ ਮਦਦ ਦੇ ਲਈ ਸਿਖ ਸਿਖਲਾਈ ਕੇਂਦਰ ਬਣੇ ਹੋਏ ਹਨ ਧੰਨਵਾਦ ਜੀ